ਮੇਰੇ ਖਿਆਲਾਂ ਦੇ ਹਿਸਾਬ ਨਾਲ ਘਰ ਦੀ ਸਵਾਈ ਚੀਜ਼ ਅਤੇ ਬਾਹਰੋਂ ਦੀ ਸੀਤੀ ਸਵਾਈ ਚੀਜ਼ ਲੈਣ ਵਿੱਚ ਬਹੁਤ ਹੀ ਜ਼ਿਆਦਾ ਡਿਫਰੈਂਸ ਪਾਇਆ ਜਾਂਦਾ ਹੈ ਘਰ ਦੀ ਬਣਾਈ ਚੀਜ਼ ਅਤੇ ਆਪਣੇ ਹੱਥੀਂ ਬਣਾਈ ਚੀਜ ਪਾਉਣ ਦਾ ਅਤੇ ਦਿਖਣ ਦਾ ਤਜ਼ਰਬਾ ਅਤੇ ਤਰੀਕਾ ਹੀ ਕੁਝ ਹੋਰ ਹੁੰਦਾ ਹੈ ਬਾਹਰ ਦੀ ਬਣਾਈ ਚੀਜ਼ ਸਾਨੂੰ ਪਸੰਦ ਤਾਂ ਆ ਜਾਂਦੀ ਹੈ ਪਰ ਕਈ ਵਾਰ ਸਾਨੂੰ ਕੱਪੜੇ ਖੁੱਲੇ ਹੁੰਦੇ ਹਨ ਕਈ ਵਾਰ ਉਹਨਾਂ ਦੀਆਂ ਤਰੀਜਾ ਖੁੱਲੀਆਂ ਆਉਂਦੀਆਂ ਹਨ ਅਤੇ ਕਈ ਵਾਰ ਕਢਾਈਆਂ ਜਿਹੜੀਆਂ ਹੁੰਦੀਆਂ ਸੀਤੀਆਂ ਹੁੰਦੀਆਂ ਹਨ ਉਹ ਬਹੁਤ ਹੀ ਲੂਜ ਹੁੰਦੀਆਂ ਹਨ ਜੋ ਕਿ ਮਿੰਟਾਂ 'ਚ ਪਾਉਣ 'ਤੇ ਖੁੱਲ ਜਾਂਦੀਆਂ ਹਨ ਘਰ ਦੀ ਬਣਾਈ ਚੀਜ਼ ਇੱਕ ਗੱਲੋ ਪੱਕੀ ਵੀ ਹੁੰਦੀ ਆ ਅਤੇ ਉੱਤੇ ਉਹ ਨਾਲ ਪੱਕੇ ਤੌਰ 'ਤੇ ਪੱਕੇ ਧਾਗੇ ਨਾਲ ਸਿਲਾਈ ਕੀਤੀ ਜਾਂਦੀ ਹੈ ਜੋ ਕਿ ਫਟਣ ਦਾ ਡਰ ਜ਼ਿਆਦਾਤਰ ਨਹੀਂ ਰਹਿੰਦਾ ਅਤੇ ਪਾਈ ਵੀ ਬਹੁਤ ਜ਼ਿਆਦਾ ਜੱਚਦੀ ਹੈ ਆਪਾਂ ਜੋ ਸਵਾਈ ਜਿਹੜੀ ਚੀਜ਼ ਸਵਾਈ ਜਾਂਦੀ ਹੈ ਉਹ ਆਪਾਂ ਆਪਣੀ ਫਿਟਿੰਗ ਦੇ ਹਿਸਾਬ ਨਾਲ ਅਤੇ ਆਪਣੀ ਬੋਡੀ ਦੇ ਹਿਸਾਬ ਨਾਲ ਸਵਾਉਂਦੇ ਹਾਂ ਅਤੇ ਬਾਹਰੋਂ ਜੋ ਸੀਤੀ ਸਵਾਈ ਚੀਜ਼ ਲਿੱਤੀ ਜਾਂਦੀ ਹੈ ਉਹਨੂੰ ਸਾਨੂੰ ਉਹਦੇ ਅਕੋਰਡਿੰਗਲੀ ਹੀ ਢਲਣਾ ਪੈਂਦਾ ਹੈ ਜੋ ਹੈ ਉਹ ਹੀ ਪਾਉਣੀ ਪੈਂਦੀ ਹੈ ਬਾਹਰ ਦੀਆਂ ਚੀਜ਼ਾਂ ਅਗਰ ਕੰਪੇਅਰ ਕਰੀਏ ਘਰ ਦੀਆਂ ਚੀਜ਼ਾਂ ਬਣਾਈਆਂ ਨਾਲ ਘਰ ਦੀ ਬਣਾਈ ਚੀਜ਼ ਬਾਹਰ ਦੀਆਂ ਚੀਜ਼ਾਂ ਨਾਲੋਂ ਬਹੁਤ ਹੀ ਜ਼ਿਆਦਾ ਸੋਹਣੀ ਅਤੇ ਪਾਈ ਸੋਹਣੀ ਜੱਚਦੀ ਹੈ ਅਸੀਂ ਘਰ ਦੇ ਇੱਥੇ ਅੰਮ੍ਰਿਤਸਰ ਵਿੱਚ ਘਰ ਦੀ ਜ਼ਿਆਦਾ ਚੀਜ਼ਾਂ ਬਣਾਈ ਜਾਂਦੀਆਂ ਹਨ ਅਤੇ ਘਰ ਦੀਆਂ ਪਾਈਆਂ ਬਣਾਈਆਂ ਚੀਜ਼ਾਂ ਹੀ ਪਾਈਆਂ ਜਾਂਦੀਆਂ ਹਨ